ਭੰਗੜਾ ਭੰਗੜਾ ਤਾਂ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ ਭੰਗੜਾ ਜਿਹੜਾ ਹੈਗਾ ਗਾ ਦੇਸ਼ ਦਾ ਪਹਿਲੇ ਨੰਬਰ 'ਤੇ ਭੰਗੜੇ ਦਾ ਸਥਾਨ ਹੈਗਾ ਇਸ ਨੂੰ ਪਹਿਲੇ ਨੰਬਰ 'ਤੇ ਮੰਨਿਆ ਜਾਂਦਾ ਹੈ ਭੰਗੜੇ ਤੋਂ ਬਿਨਾਂ ਤਾਂ ਪੰਜਾਬੀਆਂ ਦੀ ਕੋਈ ਸ਼ਾਨ ਹੀ ਨਹੀਂ ਕਿਉਂਕਿ ਭੰਗੜੇ ਨਾਲ ਬਹੁਤ ਹੀ ਜ਼ਿਆਦਾ ਸ਼ਾਨ ਹੈ ਪੰਜਾਬੀਆਂ ਦੀ ਆਹਾਂ ਪੰਜਾਬੀ ਜਿੱਥੇ ਵੀ ਜਾਂਦੇ ਉਹ ਭੰਗੜਾ ਹੀ ਕਰਦੇ ਹਨ ਤਾਂ ਹਰੇਕ ਥਾਂ 'ਤੇ ਭੰਗੜਾ ਬਹੁਤ ਜ਼ਰੂਰੀ ਹੈ ਭੰਗੜੇ ਦੀ ਜਿਹੜੀ ਮਹੱਤਤਾ ਹੈਗੀ ਦੇਸ਼ ਭਰ ਵਿੱਚ ਬਹੁਤ ਹੀ ਜ਼ਿਆਦਾ ਵੱਧ ਹੈਗੀ ਜਿੱਥੇ ਵੀ ਜਾਂਦੇ ਜਿੱਥੇ ਵਿਆਹ ਸ਼ਾਦੀ ਜਾਂ ਕੋਈ ਐਨੂਅਲ ਫੰਕਸ਼ਨ ਹੁੰਦੇ ਹੈਗੇ ਕਿਤੇ ਵੀ ਕਾਲਜਾਂ 'ਚ ਸਕੂਲਾਂ 'ਚ ਜਿਹੜੇ ਵੀ ਫੰਕਸ਼ਨ ਸਾਲ ਤੋਂ ਬਾਅਦ ਹੁੰਦੇ ਹੈਗੇ ਉੱਥੇ ਭੰਗੜਾ ਤਾਂ ਜ਼ਰੂਰ ਹੀ ਹੁੰਦਾ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਭੰਗੜਾ ਬਹੁਤ ਹੀ ਜ਼ਿਆਦਾ ਵੱਧ ਹੈਗਾ ਵੀ ਬਹੁਤ ਹੀ ਵਧੀਆ ਮੰਨਦੇ ਆ ਭੰਗੜੇ ਨੂੰ ਕਿਉਂਕਿ ਉੱਥੇ ਭੰਗੜੇ ਨੇ ਕਲਾਸਾਸ ਵੀ ਲਾਈਆਂ ਜਾਂਦੀਆਂ ਹਨ ਇੱਥੇ ਕਾਲਜਾਂ ਦੇ ਵਿੱਚ ਵੀ ਭੰਗੜੇ ਦੀ ਕਲਾਸ ਅਲੱਗ ਤੋਂ ਲੱਗਦੀ ਹੈ ਜੋ ਵੀ ਉਸ ਦੇ ਵਿੱਚ ਪਾਰਟੀਸਪੇਟ ਕਰਦਾ ਹੈ ਤਾਂ ਭੰਗੜੇ ਭੰਗੜਾ ਵੀ ਕਰ ਸਕਦਾ ਹੈ ਭੰਗੜਾ ਸਿੱਖ ਸਕਦਾ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਸਦੀ ਜਿਹੜੀ ਬਹੁਤ ਹੀ ਜ਼ਿਆਦਾ ਪ੍ਰਚਲਿਤਤਾ ਹੈ ਕਿਉਂਕਿ ਇਸਨੂੰ ਜਿਹੜਾ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਭੰਗੜਾ ਕਰਨ ਦਾ ਬਹੁਤ ਹੀ ਵਧੀਆ ਉਹ ਚੀਜ਼ ਨੂੰ ਬਹੁਤ ਹੀ ਪਸੰਦ ਕਰਦੇ ਹਨ ਜੋ ਭੰਗੜਾ ਕਰਦੇ ਹਨ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਚੀਜ਼ ਨਵੀਂ ਹੁੰਦੀ ਹੈ ਕਿ ਭੰਗੜਾ ਜਿਵੇਂ ਕਰਦੇ ਗੇ ਹੁਣ ਕਿਉਂਕਿ ਉਹਨਾਂ ਨੇ ਇਹ ਚੀਜ਼ ਕਦੀ ਦੇਖੀ ਨਹੀਂ ਹੁੰਦੀ ਉਹਨਾ ਨੂੰ ਸਿੱਖਣ ਵਾਸਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਉਹ ਹੌਲੀ ਹੌਲੀ ਅਤੇ ਬਹੁਤ ਵਧੀਆ ਸਿੱਖ ਲੈਂਦੇ ਹਨ ਪੰਜਾਬੀਆਂ ਨੂੰ ਭੰਗੜਾ ਤਾਂ ਬਹੁਤ ਹੀ ਜ਼ਿਆਦਾ ਈਜ਼ੀ ਲੱਗਦਾ ਹੈ ਬਹੁਤ ਹੀ ਵਧੀਆ ਪਾਉਂਦੇ ਹਨ ਇਸ ਕਰਕੇ ਜਿੱਥੇ ਵੀ ਕੋਈ ਵੀ ਕੋਈ ਕੰਮ ਹੋਵੇ ਤਾਂ ਭੰਗੜਾ ਤਾਂ ਬਹੁਤ ਹੁੰਦਾ ਹੀ ਹੁੰਦਾ ਹੈ ਭੰਗੜੇ ਤੋਂ ਬਿਨਾਂ ਤਾਂ ਕੋਈ ਵੀ ਚੀਜ਼ ਨਹੀਂ ਹੋ ਸਕਦੀ ਭੰਗੜਾ ਇਸ ਕਰਕੇ ਪੰਜਾਬ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਇਸ ਨੂੰ ਤਾਹੀਓਂ ਪੰਜਾਬ ਦੇ ਵਿੱਚ ਭੰਗੜਾ ਮੰਨਿਆ ਜਾਂਦਾ ਹੈ ਵੀ ਭੰਗੜੇ ਤੋਂ ਬਿਨਾਂ ਤਾਂ ਪੰਜਾਬ ਅਧੂਰਾ ਹੀ ਹੈ ਥੈਂਕ ਯੂ